ਯੋਗ ਕਰਨਾ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਯੋਗ ਦਾ ਕੋਈ ਫਿਕਸ ਟਾਈਮ ਨਹੀਂ ਹੋਣਾ ਹੁੰਦਾ ਕੋਈ ਦੁਪਹਿਰੇ ਕਰਦੇ ਹੈ ਕੋਈ ਸਵੇਰੇ ਕਰਦੇ ਕੋਈ ਸ਼ਾਮ ਨੂੰ ਕਰਦੇ ਆ ਆਪਣੇ ਆਪਣੀ ਫੁਰਸਤ ਦੇ ਹਿਸਾਬ ਨਾਲ ਇਹ ਇਹਦਾ ਟਾਈਮ ਹੁੰਦਾ ਪਰ ਮੈਂ ਜ਼ਿਆਦਾਤਰ ਯੋਗ ਜਿਹੜਾ ਸਵੇਰੇ ਕਰਦਾ ਹੁੰਦਾ ਯੋਗ ਦੇ ਵਿੱਚ ਚੁੱਪ ਚਾਪ ਬੈਠਕੇ ਮੈਂ ਯੋਗ ਕਰਦਾਂ ਠੰਡੀ ਠੰਡੀ ਹਵਾ ਜਿਸ ਵੇਲੇ ਚੱਲਦੀ ਆ ਮਨ ਬੜਾ ਚੰਗਾ ਮਹਿਸੂਸ ਹੁੰਦਾ ਸਿਹਤ ਵਾਸਤੇ ਵਧੀਆ ਲੱਗਦਾ ਕਦੇ ਕਦੇ ਤਾਂ ਮੈਂ ਕੁਛ ਦੇਰ ਸ਼ਾਂਤੀ ਨਾਲ ਬੈਠ ਕੇ ਆਪਣੇ ਸਾਹ 'ਤੇ ਧਿਆਨ ਲਗਾਉਂਦਾ ਮੈਂ ਫਿਰ ਹੌਲੀ ਹੌਲੀ ਸੂਰਜ ਵੱਲ ਵੀ ਦੇਖੀਦਾ ਸੂਰਜ ਦੀ ਰੋਸ਼ਨੀ ਵੀ ਬਹੁਤ ਜ਼ਰੂਰੀ ਆ ਹਾਂਜੀ ਪਰ ਇਹ ਇਹਦੇ ਵਿੱਚ ਕਈ ਚੀਜ਼ਾਂ ਇਨਵੋਲਵ ਹੋ ਜਾਂਦੀਆਂ ਮੈਂ ਜਿੱਦਾਂ ਹੁਣ ਤਾੜ ਆਸਣ ਹੋ ਗਿਆ ਬ੍ਰਿਕਸ ਆਸਣ ਤ੍ਰਿਕੋਣ ਅਸਣ ਭੁਜੰਗ ਆਸਣ ਵਗੈਰਾ ਚਿਮੋਤਾਣ ਆਸਣ ਆਦਿ ਵੀ ਬੜੇ ਵਧੀਆ ਆਸਣ ਹੈਗੇ ਆ ਇਹ ਹਰੇਕ ਆਸਣ ਕਰਦੇ ਸਮੇਂ ਆਪਣੇ ਸਾਹ ਦੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰੀਰ ਸਹੀ ਸਥਿਤੀ ਵਿੱਚ ਰਹੇ ਜੋ ਕਰਨ ਤੋਂ ਇਲਾਵਾ ਮੈਂ ਕੋਈ ਸਮਾਂ ਪ੍ਰਾਣਾਯਾਮ ਵੀ ਕਰਦਾ ਮੈਂ ਅਨੁਲੋਮ ਵਿਲੋਮ ਕਪਾਲ ਭਾਤੀ ਅਤੇ ਭਰਮਾਰੀ ਵਰਗੇ ਪ੍ਰਾਣਾਯਾਮ ਵੀ ਕੇ ਕਰਦਾ ਮੈਂ ਇਹ ਸਭ ਕਰਨ ਦੇ ਨਾਲ ਸਰੀਰਿਕ ਸਾਹ ਦੀ ਪ੍ਰਣਾਲੀ ਬੜੀ ਮਜ਼ਬੂਤ ਹੁੰਦੀ ਆ ਮਨ ਨੂੰ ਸ਼ਾਂਤੀ ਦਿੰਦੇ ਹੈ ਯੋਗ ਅਤੇ ਪ੍ਰਾਣਾਯਾਮ ਤੋਂ ਬਾਅਦ ਕੁਛ ਦੇਰ ਸ਼ਵ ਆਸਣ ਸਾਹ ਰੋਕ ਕੇ ਬਹਿ ਜਾਓ ਜਿੱਦਾਂ ਬੰਦਾ ਮਰਿਆ ਲੱਗੇ ਉਹ ਵੀ ਕਰੀਦਾ ਇਸ ਸਮੇਂ ਦੌਰਾਨ ਮੈਂ ਆਪਣੇ ਸਰੀਰ ਵਿੱਚ ਹੋਣ ਵਾਲੀਆਂ ਸੰਵੇਦਨਤਾ ਨੂੰ ਧਿਆਨ ਕੇਂਦਰਿਤ ਕ ਕਰਦਾ ਹਾਂ ਅਤੇ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਵੀ ਕਰਦਾ ਹੁੰਦਾ ਯੋਗਾ ਮੇਰੇ ਜੀਵਨ ਦਾ ਇੱਕ ਅਨਿੱਖੜਵਾਂ ਹਿੱਸਾ ਹੈ ਇਹਨੇ ਮੇਰੇ ਸਿਹਤ ਵਿੱਚ ਬਹੁਤ ਸੁਧਾਰ ਕੀਤਾ ਪਰ ਯੋਗਾ ਕਰਨ ਤੋਂ ਬਾਅਦ ਇਹ ਬਿਲਕੁਲ ਠੀਕ ਮਹਿਸੂਸ ਹੁੰਦਾ ਹੈ ਸਰੀਰ ਨੂੰ ਇਸ ਤੋਂ ਇਲਾਵਾ ਯੋਗਾ ਨੇ ਮੇਰੇ ਸੁਭਾਅ ਨੂੰ ਸ਼ਾਂਤ ਅਤੇ ਸਥਿਰ ਕੀਤਾ ਹੈ ਮੈਨੂੰ ਗੁੱਸਾ ਵੀ ਹੁਣ ਘੱਟ ਆਉਂਦਾ ਅਤੇ ਮੁਸ਼ਕਿਲ ਨਾਲ ਕੋਈ ਸਾਹਮਣਾ ਕਰਨਾ ਪੈ ਜਾਵੇ ਤਾਂ ਬੜੇ ਸ਼ਾਂਤੀ ਨਾਲ ਮੈਂ ਮੁਕਾਬਲਾ ਵੀ ਕਰਦਾ ਹਾਂ